ਪੈਟਰੋਲ ਦੀ ਵੱਧਦੀ ਕੀਮਤਾਂ ਨੇ ਮੇਰੀ ਬਾਈਕਿੰਗ ਨੂੰ ਕਾਫੀ ਮਾੜਾ ਅਸਰ ਪਾਇਆ ਹੈ ਮੈਂ ਲਗਭਗ ਰੋਜ਼ ਬਾਈਕ ਚਲਾਉਂਦਾ ਸੀ ਅਤੇ ਇੱਕ ਮਹੀਨੇ ਵਿੱਚ ਲਗਭਗ ਤਿੰਨ ਸੌ ਕਿਲੋਮੀਟਰ ਤੋਂ ਚਾਰ ਸੌ ਕਿਲੋਮੀਟਰ ਇੱਧਰ ਉੱਧਰ ਜਾਂਦਾ ਸੀ ਪਰ ਹੁਣ ਕੀਮਤਾਂ ਜ਼ਿਆਦਾ ਹੋਣ ਕਰਕੇ ਮੈਂ ਸਿਰਫ ਅੱਸੀ ਤੋਂ ਲੈ ਕੇ ਸੌ ਕਿਲੋਮੀਟਰ ਤੱਕ ਹੀ ਚਲਾਉਂਦਾ ਹਾਂ ਪਹਿਲਾਂ ਮੇਰਾ ਮਹੀਨੇ ਦਾ ਅੱਠ ਸੌ ਤੋਂ ਲੈ ਕੇ ਹਜ਼ਾਰ ਰੁਪਏ ਤੱਕ ਬਿੱਲ ਆਉਂਦਾ ਸੀ ਪਰ ਹੁਣ ਮੇਰਾ ਪੰਦਰਾਂ ਸੌ ਸੌ ਤੋਂ ਲੈ ਕੇ ਦੋ ਹਜ਼ਾਰ ਤੱਕ ਖਰਚ ਹੋ ਜਾਂਦੇ ਹਨ ਬਾਲਣ ਦੀ ਜ਼ਿਆਦਾ ਵਰਤੋਂ ਵਾਤਾਵਰਨ ਲਈ ਨੁਕਸਾਨਦਾਇਕ ਹੈ ਕਿਉਂਕਿ ਇਸ ਨਾਲ ਪਲੂਸ਼ਨ ਬਹੁਤ ਹੁੰਦਾ ਹੈ ਬਾਲਣ ਨਾਲ ਧੂੰਆਂ ਬਹੁਤ ਨਿਕਲਦਾ ਹੈ ਬਹੁਤ ਸਾਰੀਆਂ ਗੈਸਾਂ ਨਿਕਲਦੀਆਂ ਹਨ ਜਿਵੇਂ ਕਿ ਕਾਰਬਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਧੂੰਏ ਕੋਲ ਕਾਫੀ ਚਿਰ ਬੈਠਣ ਨਾਲ ਸਾਂਹ ਦੀ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਕੈਂਸਰ ਵਰਗੀ ਬਿਮਾਰੀ ਪੈਦਾ ਹੁੰਦੀ ਹੈ ਜ਼ਿਆਦਾ ਬਾਲਣ ਲਈ ਅਸੀਂ ਲੱਕੜਾਂ ਦੀ ਵਰਤੋਂ ਕਰਦੇ ਹਾਂ ਦਰੱਖਤ ਵੱਢਣ ਨਾਲ ਕੀ ਹੁੰਦਾ ਹੈ ਕਿ ਹੜ੍ਹ ਆਉਂਦੇ ਹਨ ਅਤੇ ਧਰਤੀ ਵਿੱਚ ਜਿਹੜਾ ਉਪਜਾਊਪਣ ਹੈ ਉਹ ਘੱਟ ਜਾਂਦਾ ਹੈ ਪੰਛੀਆਂ ਦਾ ਰਹਿਣ ਬਸੇਰਾ ਵੀ ਖਤਮ ਹੋ ਜਾਂਦਾ ਹੈ ਜਿਸ ਕਰਕੇ ਧਰਤੀ ਉੱਤੇ ਅਸੰਤੁਲਨ ਦੀ ਕਿਰਿਆ ਸ਼ੁਰੂ ਹੋ ਗਈ ਹੈ ਅਨਬੈਲੈਂਸ ਸ਼ੁਰੂ ਹੋ ਗਿਆ ਹੈ ਇਸ ਕਰਕੇ ਪੰਛੀ ਜੰਗਲਾਂ ਨੂੰ ਛੱਡ ਕੇ ਸ਼ਹਿਰ ਵਿੱਚ ਆ ਕੇ ਰਹਿਣ ਲੱਗ ਜਾਂਦੇ ਹਨ ਕੁਦਰਤੀ ਆਫਤ ਜਿਵੇਂ ਕਿ ਹੜ੍ਹ ਆਉਣਾ ਲੱਗ ਪਏ ਹਨ